ਭਾਅ ਜੀ ਬੇਸੀਕਿਲੀ ਮੇਰਾ ਬੈਂਕ ਸਰਵਰ ਡਾਊਨ ਹੈ ਤਾਂ ਮੇਰਾ ਔਨਲਾਈਨ ਪੇਅਮੈਂਟਸ ਚੱਲ ਨਹੀਂ ਰਿਹਾ ਪੇਅਮੈਂਟ ਗੇਟਵੇਅ ਬਲੌਕ ਆ ਰਿਹਾ ਹੈ ਕੀ ਤੁਹਾਡੇ ਕੋਲ ਕੋਈ ਔਪਸ਼ਨ ਏਦਾਂ ਦਾ ਹੈ ਕਿ ਅਸੀਂ ਤੁਹਾਨੂੰ ਕੈਸ਼ ਪੇਅਮੈਂਟ ਦੇ ਸਕੀਏ